ਕਰੋਨਾ ਮਹਾਂਮਾਰੀ ਦੇ ਆਉਣ ਦੇ ਨਾਲ ਕਾਰੋਬਾਰਾਂ ਵਿੱਚ ਬਹੁਤ ਸਾਰਾ ਆਪਾਂ ਫੇਰ ਬਦਲ ਦੇਖਿਆ ਇਸ ਵਿੱਚ ਅਸੀਂ ਇਹ ਦੇਖਿਆ ਕਿ ਜਿਹੜਾ ਕੰਮ ਪਹਿਲਾਂ ਅਸੀਂ ਆਪ ਇੱਧਰ ਉੱਧਰ ਆ ਜਾ ਕੇ ਕਰਦੇ ਸੀਗੇ ਉਹ ਹੁਣ ਸਾਰਾ ਕੰਮ ਆਨਲਾਈਨ ਹੋਣ ਲੱਗ ਪਿਆ ਹੈ ਅਤੇ ਉਸ ਦੌਰਾਨ ਉਸ ਦੌਰਾਨ ਅਸੀਂ ਦੇਖਿਆ ਕਿ ਕਰੋਨਾ ਮਹਾਂਮਾਰੀ ਦੇ ਵਿੱਚ ਬਹੁਤ ਸਾਰੇ ਫ਼ਾਇਦੇ ਵੀ ਹੋਏ ਅਤੇ ਨੁਕਸਾਨ ਵੀ ਹੋਏ ਅਗਰ ਫਾਇਦਿਆਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਜੀਣ ਦਾ ਇੱਕ ਤਰੀਕਾ ਮਿਲਿਆ ਕਿ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਰੱਖ ਕੇ ਕਿਵੇਂ ਜੀਣਾ ਹੈ ਅਤੇ ਨੁਕਸਾਨ ਇਹ ਹੋਇਆ ਕਿ ਉਸ ਦੌਰਾਨ ਸਾਨੂੰ ਕਈ ਜਗ੍ਹਾ ਤੋਂ ਘਾਟੇ ਵੀ ਪਏ ਕਿਉਂਕਿ ਸਾਡੇ ਕਈ ਕਾਰੋਬਾਰ ਬੰਦ ਹੋ ਗਏ ਜਿਨ੍ਹਾਂ ਨਾਲ ਸਾਨੂੰ ਨੁਕਸਾਨ ਵੀ ਝੱਲਣਾ ਪਿਆ ਔਰ ਸਾਡੇ ਖੇਤਰ ਦੇ ਵਿੱਚ ਦੇਖਿਆ ਜਾਵੇ ਤਾਂ ਕਈ ਕਾਰੋਬਾਰ ਬੰਦ ਵੀ ਹੋਏ ਅਤੇ ਕਈ ਕਾਰੋਬਾਰ ਬਹੁਤ ਫਲ ਫੁੱਲ ਵੀ ਗਏ ਜਿਵੇਂ ਕਿ ਸਾਡੇ ਸ਼ੋ ਰੂਮ ਜਿਹੜੇ ਸੀਗੇ ਕੱਪੜਿਆਂ ਦੇ ਉਹ ਕਈ ਜਿਹੜੇ ਚੱਲ ਰਹੇ ਸੀਗੇ ਉਹ ਬੰਦ ਹੋ ਗਏ ਕਿਉਂਕਿ ਡੇਢ ਤੋਂ ਦੋ ਸਾਲ ਤੱਕ ਜਦੋਂ ਕੋਈ ਕੰਮ ਨਾ ਹੋਇਆ ਤਾਂ ਫਿਰ ਉਹਨਾਂ ਨੂੰ ਆਪਣਾ ਕੰਮ ਬੰਦ ਕਰਕੇ ਬਦਲਣਾ ਪਿਆ ਜਾਂ ਕੋਈ ਹੋਰ ਜਗ੍ਹਾ ਦੇ ਉੱਤੇ ਕੰਮ ਕਰਨਾ ਪਿਆ ਜਾਂ ਹੋਰ ਕੰਮ ਕਰਨ ਵਿੱਚ ਲੱਗ ਗਏ ਅਤੇ ਕਈਆਂ ਦਾ ਕੰਮ ਬਹੁਤ ਫੈਲ ਵੀ ਗਿਆ ਜਿਵੇਂ ਕਿ ਕਰਿਆਨੇ ਵਾਲਿਆਂ ਦਾ ਜਿਵੇਂ ਕਿ ਦਵਾਈਆਂ ਵਾਲਿਆਂ ਦਾ ਉਹਨਾਂ ਨੂੰ ਬਹੁਤ ਫ਼ਾਇਦਾ ਵੀ ਹੋਇਆ ਔਰ ਇਸ ਤਰ੍ਹਾਂ ਨਾਲ ਕਰੋਨਾ ਮਹਾਂਮਾਰੀ ਨੇ ਸਾਨੂੰ ਇੱਕ ਗੱਲ ਸਿਖਾਈ ਕਿ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਚਾਹੀਦੀ ਹੈ